ਗਾਇਕੀ ਵਿੱਚ ਰਾਗਾਂ ਦੀ ਬਹੁਤ ਮਹੱਤਤਾ ਹੈ ਰਾਗਾਂ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਕਿਸ ਗਾਣੇ ਵਿੱਚ ਕਿਹੜਾ ਰਾਗ ਵਰਤਿਆ ਗਿਆ ਹੈ ਅਤੇ ਕਿਹੜਾ ਗਾਣਾ ਕਿਸ ਰਾਗ ਦੇ ਵਿੱਚ ਆਉਂਦਾ ਹੈ ਰਾਗਾਂ ਦੇ ਨਾਲ ਸਾਨੂੰ ਪਤਾ ਲੱਗਦਾ ਹੈ ਕਿ ਅਸੀਂ ਗਾਉਣ ਦੀ ਕਿੱਦਾਂ ਵਰਤੋਂ ਕਰ ਸਕਦੇ ਹਾਂ ਅਤੇ ਆਪਣੇ ਸਾਜ਼ਾਂ ਨੂੰ ਕਿੱਦਾਂ ਅਸੀਂ ਵਰਤ ਸਕਦੇ ਹਾਂ ਇਸ ਨੇ ਇਲਾਵਾ ਸਾਡੇ ਕੋਲ ਤਿੰਨ ਰਾਗ ਹਨ ਜਿਹਨਾਂ ਦੀ ਅਸੀਂ ਗੱਲ ਕਰਨਾ ਚਾਹਾਂਗੇ ਇਸਦੇ ਵਿੱਚ ਹਨ ਪਹਿਲਾ ਰਾਗ ਹੈ ਭੈਰਵ ਰਾਗ ਜਿਸ ਨਾਲ ਜੋ ਕਿ ਬਹੁਤ ਹੀ ਆਸਾਨ ਹੈ ਅਤੇ ਆਸਾਨੀ ਨਾਲ ਵਰਤਿਆ ਜਾਂਦਾ ਹੈ ਜ਼ਿਆਦਾਤਰ ਗਾਇਕੀ ਇਸ ਦੇ ਨਾਲ ਚੱਲਦੀ ਹੈ ਜੋ ਕਿ ਗਾਇਕ ਬਹੁਤ ਹੀ ਆਮ ਯੂਜ ਕਰਦੇ ਹਨ ਅਤੇ ਇਹਨਾਂ ਰਾਗਾਂ ਵਿੱਚ ਹੋਰ ਵੀ ਰਾਗ ਹਨ ਜਿੱਦਾਂ ਕਿ ਭੈਰਵੀ ਰਾਗ ਭੈਰਵੀ ਰਾਗ ਅਲੱਗ ਸਮੇਂ ਵਰਤਿਆ ਜਾਂਦਾ ਹੈ ਇਹ ਰਾਗ ਸਵੇਰ ਦੇ ਸਮੇਂ ਚਾਰ ਤੋਂ ਸੱਤ ਦੇ ਵਿੱਚ ਕੀਤਾ ਜਾਂਦਾ ਹੈ ਤਾਂ ਕਿ ਸਾਡੇ ਗਲੇ ਨੂੰ ਆਰਾਮ ਦਿੱਤਾ ਜਾਵੇ ਅਤੇ ਇਹਨਾਂ ਦੇ ਨਾਲ ਸਾਡੇ ਗਲੇ ਵਿੱਚ ਗਹਿਰਾਈ ਆਉਂਦੀ ਹੈ ਅਤੇ ਅਗਲਾ ਰਾਗ ਹੈ ਮਾਰਵਾੜੀ ਰਾਗ ਜਿਸ ਨਾਲ ਗਾਇਕੀ ਦਾ ਥੋੜ੍ਹਾ ਤਾਲੁਕ ਹੈ ਪਰੰਤੂ ਇਹ ਰਾਗ ਕੁਛ ਗਾਇਕੀ ਯੂਜ ਕਰਦੇ ਹਨ ਇਹਨਾਂ ਰਾਗਾਂ ਵਿੱਚ ਸਾਡੇ ਹੋਰ ਵੀ ਰਾਗ ਹਨ ਪਰ ਜ਼ਿਆਦਾਤਰ ਵਰਤੇ ਜਾਣ ਵਾਲੇ ਰਾਗ ਭੈਰਵ ਅਤੇ ਭੈਰਵੀ ਰਾਗ ਹੀ ਹਨ ਧੰਨਵਾਦ